ਭਾਰਤ ਵਿੱਚ ਬਹੁਤ ਸਾਰੇ ਧਾਰਮਿਕ ਸਥਾਨ ਹਨ ਹਿੰਦੂਆਂ ਦੇ ਮੰਦਰ ਅੰਮ੍ਰਿਤਸਰ ਵਿੱਚ ਦੁਰਗਿਆਣਾ ਮੰਦਰ ਹੈ ਅਤੇ ਮੁਸਲਮਾਨਾਂ ਦੇ ਮਸੀਤਾਂ ਇੱਥੇ ਬਹੁਤ ਹਨ ਅਤੇ ਸਿੱਖਾਂ ਦੇ ਧਾਰਮਿਕ ਸਥਾਨ ਦਰਬਾਰ ਸਾਹਿਬ ਸਵਰਨ ਮੰਦਰ ਹੈ ਇੱਥੇ ਬਹੁਤ ਸਾਰੇ ਮੰਦਰ ਹਨ ਅਤੇ ਬਹੁਤ ਸਾਰੀਆਂ ਮਸਜਿਦਾਂ ਹਨ ਇੱਥੇ ਕੁਛ ਚਰਚ ਵੀ ਹਨ ਜਿਹੜੇ ਕਿ ਈਸਾਈ ਧਰਮ ਦੇ ਹਨ ਇਹ ਈਸਾਈ ਧਰਮ ਦੇ ਜਦੋਂ ਛੱਬੀ ਜਨਵਰੀ ਹੈ ਉਦੋਂ ਹਜ਼ਰਤ ਮਸੀਹ ਦੀ ਯਾਦ ਮਨਾਈ ਜਾਂਦੀ ਹੈ ਉਹਨਾਂ ਦਾ ਜਨਮ ਮਨਾਇਆ ਜਾਂਦਾ ਹੈ ਅਤੇ ਜਿਹੜੇ ਧਾਰਮਿਕ ਸਥਾਨ ਹਿੰਦੂਆਂ ਦੇ ਆ ਉਹਨਾਂ ਦੇ ਸ਼ਿਵਰਾਤਰੀ ਮਨਾਈ ਜਾਂਦੀ ਹੈ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਜਾਂਦੀ ਹੈ ਕਾਫੀ ਸਾਰੇ ਹੋਰ ਵੀ ਮੰਦਰ ਹਨ ਅਤੇ ਜਿਹੜੇ ਸਿੱਖਾਂ ਦੇ ਗੁਰਦੁਆਰੇ ਹਨ ਇਹਨਾਂ ਵਿੱਚ ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਦਾ ਸਥਾਨ ਹੈ ਜਿੱਥੇ ਕਿ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ ਦਿਵਾਲੀ ਮਨਾਈ ਜਾਂਦੀ ਹੈ ਅਤੇ ਵਿਸਾਖੀ ਮਨਾਈ ਜਾਂਦੀ ਹੈ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ 'ਚੋਂ ਰਿਹਾ ਹੋ ਕੇ ਅੰਮ੍ਰਿਤਸਰ ਪਹੁੰਚੇ ਤਾਂ ਸਿੱਖਾਂ ਨੇ ਇੱਥੇ ਬੜੀ ਧੂਮ ਧਾਮ ਨਾਲ ਦੀਪਮਾਲਾ ਕੀਤੀ